ਨਮਸਤੇ ਹਾਂ ਮੈਨੂੰ ਆਪਣੇ ਪੰਜਾਬੀ ਸੱਭਿਆਚਾਰਕ ਦੀ ਸ਼ੈਲੀ ਕਿਤਾਬਾਂ ਦੀਆਂ ਕਿਤਾਬਾਂ ਬਹੁਤ ਪਸੰਦ ਹਨ ਜਿਸ ਵਿੱਚ ਸਾਡੇ ਪੰਜਾਬੀ ਸੱਭਿਆਚਾਰਕ ਭਾਈਚਾਰੇ ਅਤੇ ਮੇਲਿਆਂ ਤਿਉਹਾਰਾਂ ਆਦਿ ਆਉਂਦੇ ਹਨ ਅਤੇ ਮੈਨੂੰ ਅੰਮ੍ਰਿਤ ਪ੍ਰੀਤਮ ਸ਼ਿਵ ਕੁਮਾਰ ਬਟਾਲਵੀ ਨੰਦ ਲਾਲ ਪੁਰੀ ਦੀਆਂ ਕਤਾਵਾਂ ਕਵਿਤਾਵਾਂ ਵਾਲੀਆਂ ਕਿਤਾਬਾਂ ਪੜ੍ਹਨੀਆਂ ਬਹੁਤ ਚੰਗੀਆਂ ਲੱਗਦੀਆਂ ਹਨ ਅਤੇ ਪੰਜਾਬ ਵਿੱਚ ਪੁਰਾਣੇ ਬਰਤਨ ਪੁਰਾਣੇ ਘਰ ਅਤੇ ਖੇਤੀਬਾੜੀ ਆਦਿ ਸਾਡਾ ਸੱਭਿਅਕ ਚ ਚਾਰਾ ਹੈ ਅਤੇ ਮੈਂ ਹਾਲ ਵਿੱਚ ਨੰਦ ਲਾਲ ਨੂਰਪੁਰੀ ਦੀ ਕਿਤਾਬ ਪੜ੍ਹ ਪੜ੍ਹੀ ਹੈ ਜਿਸ ਵਿੱਚ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਦਾ ਦਾ ਜ਼ਿਕਰ ਹੋਇਆ ਹੈ ਜਿਸ ਵਿੱਚ ਲਿਖਿਆ ਹੈ ਚੁੰਮ ਚੁੰਮ ਰੱਖਾਂ ਕਲਗੀ ਜੁਝਾਰ ਦੀ ਮੈਂ ਪੜ੍ਹੀ ਹੈ ਧੰਨਵਾਦ